ਮੇਰੇ ਮਨ ਪਸੰਦ ਡਰਾਇੰਗ ਟੂਲ ਪੈਨਸਲ ਕਲਰ ਪੈਨਸਲ ਮਾਰਕਰ ਅਤੇ ਡਿਜੀਟਲ ਟੂਲ ਹਨ ਜਦੋਂ ਵੀ ਮੈਂ ਡਰਾਇੰਗ ਕਰਦਾ ਹਾਂ ਸਭ ਤੋਂ ਪਹਿਲਾਂ ਪੈਨਸਲ ਨਾਲ ਰੋਹਾਂ ਖਿੱਚਦਾ ਹਾਂ ਪੈਂਸਿਲ ਦਾ ਫ਼ਾਇਦਾ ਇਹ ਹੁੰਦਾ ਹੈ ਕਿ ਜੇ ਕੋਈ ਗਲਤੀ ਹੋ ਜਾਵੇ ਤਾਂ ਰਬੜ ਨਾਲ ਸੌਖੀ ਤਰ੍ਹਾਂ ਮਿਟ ਸਕਦਾ ਹੈ ਫਿਰ ਜਦੋਂ ਮੈਨੂੰ ਲੱਗਦਾ ਹੈ ਕਿ ਆਊਟਲਾਈਨ ਵਧੀਆ ਬਣ ਗਈ ਤਾਂ ਮੈਂ ਮਾਰਕਰ ਜਾਂ ਇੱਕ ਪੈਨ ਨਾਲ ਲਾਈਨਾਂ ਨੂੰ ਹੌਲੀ ਹੌਲੀ ਪੱਕਾ ਕਰ ਦਿੰਦਾ ਹਾਂ ਇਸ ਨਾਲ ਡਰਾਇੰਗ ਚੌਖੀ ਅਤੇ ਹੌਲੀ ਬਣਦੀ ਹੈ ਜੇਕਰ ਮੈਨੂੰ ਸ਼ੇਡਿੰਗ ਕਰਨੀ ਹੋਵੇ ਤਾਂ ਮੈਂ ਕਲਰ ਪੈਨਸਲ ਜਾਂ ਚਾਰਕੁੱਲ ਵਰਤਦਾ ਹਾਂ ਚਾਰਕੁੱਲ ਨਾਲ ਡਿਪਥ ਆ ਜਾਂਦੀ ਹੈ ਡਰਾਇੰਗ ਹੋਰ ਨਵੀਂ ਲੱਗਦੀ ਹੈ ਡਿਜੀਟਲ ਡਰਾਇੰਗ ਲਈ ਮੈਂ ਟੈਬਲੇਟ 'ਤੇ ਸਟਾਈਲਸ ਵਰਤਦਾ ਹਾਂ ਇਹ ਆਉਣ ਵਾਲੇ ਸਮੇਂ ਦੀ ਲੋੜ ਵੀ ਹੈ ਅਤੇ ਆਸਾਨ ਵੀ ਡਿਜੀਟਲ ਸੋਫਟਵੇਅਰ ਵਿੱਚ ਲੇਅਰਸ ਹੁੰਦੇ ਹਨ ਜਿਨ੍ਹਾਂ ਨਾਲ ਗਲਤੀ ਹੋਵੇ ਤਾਂ ਆਸਾਨੀ ਨਾਲ ਠੀਕ ਕੀਤਾ ਜਾ ਸਕਦਾ ਹੈ ਕਈ ਵਾਰ ਮੈਨੂੰ ਪੇਂਟਿੰਗ ਦੀ ਵੀ ਬਹੁਤ ਲੋੜ ਪੈਂਦੀ ਹੈ ਤਾਂ ਮੈਂ ਵਾਟਰ ਕਲਰ ਜਾਂ ਐਕਰੀਲਿਕ ਪੇਂਟ ਵਰਤਦਾ ਹਾਂ ਇਹਨਾਂ ਨਾਲ ਰੰਗ ਹੋਰ ਵੀ ਵਿਖਾਵਟ ਵਾਲੇ ਅਤੇ ਜ਼ਿੰਦਗੀ ਭਰਦੇ ਹਨ ਆਖਰ ਵਿੱਚ ਡਰਾਇੰਗ ਲਈ ਕੋਈ ਵੀ ਟੂਲ ਸਭ ਤੋਂ ਵਧੀਆ ਗੱਲ ਇਹ ਹੁੰਦੀ ਹੈ ਕਿ ਉਹ ਤੁਹਾਡੀ ਕਲਪਨਾ ਨੂੰ ਰੂਪ ਦੇਣ ਵਿੱਚ ਮਦਦ ਕਰਦਾ ਹੈ